ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਅੱਛਾ ਕਦੋਂ ਅੱਛਾ ਅੱਛਾ ਦਿਨ ਵੀ ਦਿਨ ਤਾਂ ਦੱਸੋ ਨਾ ਫਿਰ ਤਾਂ ਹੀ ਉਸ ਹਿਸਾਬ ਨਾਲ਼ ਅਸੀਂ ਕਰਾਂਗੇ ਨਾ ਚਲੋ ਠੀਕ ਹੈ ਠੀਕ ਹੈ ਠੀਕ ਹੈ ਕਰਦਾਂਗੇ ਕਰਦਾਂਗੇ ਹਾਂਜੀ ਖ਼ਰਚਾ ਹੁਣ ਤੁਸੀਂ ਆਪਣੇ ਹਿਸਾਬ ਨਾਲ਼ ਦੱਸੋ ਨਾ ਵੀ ਕਿੰਨਾਂ ਕੁ ਤੁਸੀਂ ਲਾਣਾ ਚਾਹੁੰਦੇ ਹੋ ਮੈਂ ਉਨਾਂ ਕੁ ਦੱਸ ਦਿੰਦੀ ਆ ਅੱਛਾ ਠੀਕ ਹੈ ਫਿਰ ਮੈਂ ਕਰਦੂਗੀ ਮੈਂ ਕਰਦੂਗੀ ਕਰਦੂਗੀ ਹਾਂਜੀ ਹਾਂਜੀ ਮੈਂ ਕਰਦੂਗੀ ਅਤੇ ਮੈਂ ਉਹੀ ਕਹਿੰਦੀ ਤਿੰਨ ਚਾਰ ਸਬਜ਼ੀਆਂ ਹੋਣਗੀਆਂ ਦੋ ਮਿੱਠੇ ਹੋਊਂਗੇ ਰਾਇਤਾ ਹੋਊਂਗਾ ਚਾਵਲ ਹੋਊਂਗੇ ਅਤੇ ਫਿਰ ਟਿੱਕੀ ਹੋਊਂਗੀ ਨਿਊਡਲਜ਼ ਹੋਣਗੇ ਅਤੇ ਫਿਰ ਡੈਕੋਰੇਸ਼ਨ ਵੀ ਨਾਲ਼ ਹੀ ਹੋਊਂਗੀ ਡੈਕੋਰੇਸ਼ਨ ਵੀ ਨਾਲ਼ ਹੀ ਹੋਏਗੀ ਹਾਂ ਹਾਂ ਹਾਂ ਹਾਂ ਚਲੋ ਠੀਕ ਹੈ ਹਾਂਜੀ ਠੀਕ ਹੈ ਚਲੋ ਠੀਕ ਹੈ ਓਕੇ